ਮੈਨੂੰ ਅਚਾਨਕ ਵਿੱਤੀ ਲੈਣ ਦੇਣ ਲਈ ਤੁਰੰਤ ਪੈਨ ਕਾਰਡ ਦੀ ਜਰੂਰਤ ਪੈ ਗਈ ਹੈ ਇਸ ਸਮੇਂ ਮੇਰੇ ਕੋਲ ਪੈਨ ਕਾਰਡ ਮੌਜੂਦ ਨਹੀਂ ਹੈ ਇਸ ਲਈ ਮੈਂ ਪੈਨ ਕਾਰਡ ਸਹਾਇਤਾ ਟੀਮ ਨੂੰ ਆਗਰਾ ਕਰਦੇ ਹਾਂ ਕਿ ਉਹ ਮੇਰੇ ਪ੍ਰਵਾਨਗੀ ਨੰਬਰ ਅਤੇ ਮੇਰੀ ਜਨਮ ਮਿਤੀ ਦੀ ਵਰਤੋਂ ਕਰਕੇ ਮੇਰੀ ਅਰਜੀ ਦੀ ਜਾਂਚ ਕਰਨ ਅਤੇ ਮੇਰੀ ਸਹਾਇਤਾ ਕਰਨ